ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਖਰੜ ਤੋਂ ਅਮਰਜੀਤ ਸਿੰਘ ਬੋਲ ਰਿਹਾ ਹਾਂ ਤੁਹਾਡਾ ਇੱਕ ਮੈਂ ਫੋਨ ਔਨਲਾਈਨ ਬੁੱਕ ਕੀਤਾ ਸੀ ਜੋ ਮੈਨੂੰ ਅੱਜ ਮਿਲ ਗਿਆ ਹੈ ਜਦੋਂ ਮੈਂ ਇਹ ਫੋਨ ਖੋਲ ਕੇ ਦੇਖਿਆ ਤਾਂ ਫੋਨ ਇਸ ਦੀ ਲੁਕ ਬਹੁਤ ਹੀ ਵਧੀਆ ਸੀ ਅਤੇ ਇਸ ਦਾ ਵੀਰ ਕੈਮਰਾ ਮੈਂ ਚੈੱਕ ਕੀਤਾ ਕੈਮਰਾ ਬਹੁਤ ਹੀ ਵਧੀਆ ਸੀ ਸਕਰੀਨ ਵੀ ਅਲਟੀਮੇਟ ਸੀ ਬੈਟਰੀ ਬੈਕਅਪ ਬਹੁਤ ਵਧੀਆ ਦੇ ਰਿਹਾ ਇਹ ਆਵਾਜ਼ ਵੀ ਇਸਦੀ ਬਹੁਤ ਵਧੀਆ ਆ ਰਹੀ ਹੈ ਅਤੇ ਫਿਰ ਮੈਂ ਆਪਣੇ ਹੋਰ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨੂੰ ਫੋਨ ਚੈੱਕ ਕਰਾ ਕੀਤਾ ਕਰਵਾਇਆ ਉਨਾਂ ਨੇ ਵੀ ਚੈੱਕ ਕਰਨ ਉਪਰੰਤ ਇਹੀ ਕਿਹਾ ਵੀ ਫੋਨ ਬਹੁਤ ਵਧੀਆ ਹੈ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਇਹ ਫੋਨ ਤੁਸੀਂ ਕਿੱਥੋਂ ਮੰਗਵਾਇਆ ਹੈ ਫਿਰ ਮੈਂ ਉਹਨਾਂ ਨੂੰ ਤੁਹਾਡਾ ਐਡਰੈਸ ਦਿੱਤਾ ਅਤੇ ਉਹਨਾਂ ਨੇ ਵੀ ਫੋਨ ਮੰਗਵਾਉਣਾ ਹੈ ਇਸ ਲਈ ਤੁਹਾਡੀ ਜਿਹੜੀ ਸਰਵਿਸ ਬਹੁਤ ਵਧੀਆ ਹੈ